ਜੇਕਰ ਮੈ ਪਕਵਾਨਾਂ ਬਾਰੇ ਗੱਲ ਕਰਾਂ ਤਾਂ ਮੈਨੂੰ ਪਕਵਾਨ ਬ ਬਣਾਉਣੇ ਬਹੁਤ ਪਸੰਦ ਹਨ ਮੈਂ ਆਪਣੇ ਘਰ ਵਿੱਚ ਆਪ ਹੀ ਪਕਵਾਨ ਬਣਾਉਂਦੀ ਹਾਂ ਅਤੇ ਆਪਣੇ ਸਾਰੇ ਪਰਿ ਪਰਿਵਾਰ ਦੇ ਮੈਂਬਰਾਂ ਨੂੰ ਖਵਾਉਂਦੀ ਵੀ ਹਾਂ ਉਨ੍ਹਾਂ ਨੂੰ ਮੇਰੇ ਵ ਦੁਆਰਾ ਬਣਾਏ ਗਏ ਪਕਵਾਨ ਬਹੁਤ ਪਸੰਦ ਆਉਂਦੇ ਹਨ ਉਨ੍ਹਾਂ ਨੂੰ ਉਹ ਬਹਤ ਵਧੀਆ ਲੱਗਦੇ ਹਨ ਜੇਕਰ ਮੈਂ ਕਿਸੇ ਨੂੰ ਸਿਖਾਉਣਾ ਹੋਵੇ ਜਾਂ ਦਿਖਾਉਣਾ ਹੋਵੇ ਕਈ ਵਾਰ ਮੇਰੇ ਰਿਸ਼ਤੇਦਾਰ ਮੇਰੇ ਘਰ ਆ ਕੇ ਵੀ ਮੇਤੋਂ ਪਕਵਾਨ ਬਣਾਉਣੇ ਸਿੱਖਦੇ ਹਨ ਜਿਸ ਨਾਲ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਈ ਵਾਰ ਉਹ ਮੈਨੂੰ ਫੋਨ ਕਰਕੇ ਪੁੱਛਦੇ ਹਨ ਵੀ ਇਸ ਪਕਵਾਨ ਨੂੰ ਕਿੱਦਾਂ ਬਣਾਉਣਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦ ਮੈਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਇਸਨੂੰ ਕਿਸ ਪਕਵਾਨਾਂ ਨੂੰ ਕਿਸ ਤਰ੍ਹਾਂ ਬਣਾਉਂਦੇ ਹੋ ਜੇਕਰ ਮੈਂ ਸਾਧਨਾਂ ਦੀ ਗੱਲ ਕਰਾਂ ਤਾਂ ਮੈਂ ਆਪਣੀ ਵੀਡੀਓਜ਼ ਬਣਾ ਕੇ ਯੂਟਿਊਬ 'ਤੇ ਵੀ ਅਪਲੋਡ ਕਰਦੀ ਹਾਂ ਅਤੇ ਇੰਸਟਾਗ੍ਰਾਮ 'ਤੇ ਵੀ ਅਪਲੋਡ ਕਰਦੀ ਹਾਂ ਜਿਸ ਨਾਲ ਮੇਰੇ ਰਿਸ਼ਤੇਦਾਰ ਵੀਡੀਓਜ਼ ਦੇਖ ਕੇ ਵੀ ਬਹੁਤ ਖੁਸ਼ ਹੁੰਦੇ ਹਨ ਅਤੇ ਜੋ ਵੀ ਮੇਰੇ ਫੋਲੋਵਰ ਜਾਂ ਸਬਸਕ੍ਰਾਈਬਰਜ਼ ਹਨ ਉਹਨਾਂ ਨੂੰ ਵੀ ਮੇਰੇ ਪਕਵਾਨਾਂ ਬਾਰੇ ਪਤਾ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੇਰੇ ਦੁਆਰਾ ਬਣਾਏ ਗਏ ਭੋਜਨ ਬਹੁਤ ਪਸੰਦ ਹਨ ਮੈਂ ਆਪਣੇ ਪਕਵਾਨਾਂ ਨੂੂੰ ਬਹਤ ਮਨ ਲਗਾ ਕੇ ਬਣਾਉਂਦੀ ਹਾਂ ਅਤੇ ਮੈਂ ਜੋ ਭੋਜਨ ਬਣਾਉਂਦੀ ਹਾਂ ਉਹ ਸਾਰਿਆਂ ਨੂੰ ਪਸੰਦ ਆਉਂਦਾ ਹੈ